ਹੈਲੋ ਸਤਿ ਸ਼੍ਰੀ ਅਕਾਲ ਸਰ ਯਾਦਵਿੰਦਰ ਜੀ ਬੋਲ ਰਹੇ ਹੈ ਜੀ ਠੀਕ ਹੈ ਵੀਰ ਜੀ ਮੈਂ ਵੀਰੇ ਬਾਹਰੋਂ ਆਇਆ ਵਾ ਰਹਿਣ ਉਰੇ ਹਾਂਜੀ ਮੈਂ ਵੀਰੇ ਉਰੇ ਕਿਹੜੀਆਂ ਕਿਹੜੀਆਂ ਜਗ੍ਹਾ ਹੈ ਜੀ ਘੁੰਮਣ ਵਾਸਤੇ ਅਤੇ ਜਗ੍ਹਾ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਮੈਂ ਤੁਹਾਡਾ ਮੈਂ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਹਾਂਜੀ ਮੇਰਾ ਨੰਬਰ ਕਰ ਲਓ ਸੇਵ ਤੁਸੀਂ ਵਿੱਚੇ ਫੋਨ 'ਚ ਮੈਂ ਨਾ ਜ਼ਰੂਰ ਤੁਹਾਡੇ ਨਾਲ ਸੰਪਰਕ ਕਰੂੰਗਾ ਆ ਕੇ ਵੀਰ ਮੈਂ ਮੈਂ ਮੈਂ ਪੰਦਰਾਂ ਵੀਹ ਦਿਨ ਵਿੱਚ ਆਉਂਗਾ ਤੁਹਾਡੇ ਕੋਲ ਜ਼ਰੂਰ ਵੀਰ ਹਾਂ ਹੋਰ ਘਰ ਪਰਿਵਾਰ ਵਧੀਆ ਵੀਰ ਹਾਂ ਵੀਰੇ ਮੈਂ ਜ਼ਰੂਰ ਤੁਹਾਨੂੰ ਦੋ ਦਿਨ ਪਹਿਲਾਂ ਫੋਨ ਕਰਦੂੰਗਾ ਪਰ ਆਪਣਾ ਫ੍ਰੀ ਹੋ ਕੇ ਰਿਹੋ ਬੁੱਕ ਨਾ ਕਰਿਓ ਕੋਈ ਹੋਰ ਜੀ ਕੰਮ ਹੋਰ ਪਾਸੇ ਨਾ ਲੰਗਿਓ ਚੱਲੋ ਠੀਕ ਆ ਵੀਰ ਚੰਗਾ ਜੀ ਓਕੇ ਜੀ ਓਕੇ ਧੰਨਵਾਦ